ਵੈਸੇ ਤਾਂ ਦੇਖਿਆ ਜਾ ਸਕਦਾ ਹੈਗਾ ਏ ਜਿਹੜਾ ਕੋਈ ਵੀ ਹਰ ਇੱਕ ਮਨੁੱਖ ਉਹਦੀ ਜ਼ਿੰਦਗੀ 'ਤੇ ਟਕਨੋਲਜੀ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਹੈਗਾ ਟਕਨੋਲਜੀ ਉਹਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗੀ ਵੀ ਹੈਗੀ ਹੈ ਕਿ ਇਹਦਾ ਮਤਲਬ ਕਿੱਦਾਂ ਬਈ ਪਈ ਬੰਦਾ ਕਿਸੇ ਨਾ ਕਿਸੇ ਢੰਗ ਨਾਲ਼ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਟਕਨੋਲਜੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ਼ ਉਹ ਵਰਤਦਾ ਹੈਗਾ ਹੈ ਜਿੱਦਾਂ ਮੰਨ ਲਓ ਬਈ ਜਿੱਦਾਂ ਮੰਨ ਲਓ ਮੈਂ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਜਿਹੜੀ ਜ਼ਿਆਦਾ ਚੀਜ਼ਾਂ ਵਰਤਦਾ ਉਹਦੇ 'ਚੋਂ ਜ਼ਿਆਦਾ ਹੈਗਾ ਇੱਕ ਤਾਂ ਮਬੈਲ ਵਰਤਦਾ ਹੈਗਾ ਮੈਂ ਇੱਕ ਆਪਣਾ ਮੋਟਰਸੈਕਲ ਵਰਤਦਾ ਹੈਗਾ ਹੈ ਮੈਂ ਉਸ ਤੋਂ ਇਲਾਵਾ ਜਿਹੜਾ ਮੈਂ ਆਪਣਾ ਇੱਕ ਲੈਪਟੋਪ ਵਰਤਦਾ ਹੈਗਾ ਏ ਅਤੇ ਇਹਨਾਂ ਚੀਜ਼ਾਂ ਦਾ ਆਪਣੀ ਜਿੰਦਗੀ ਵਿੱਚ ਜਿਹੜਾ ਹੈਗਾ ਏ ਜ਼ਿਆਦਾ ਯੂਜ ਕਰਦਾ ਹੈਗਾ ਏ ਜਿਹੜਾ ਮੈਂ ਜਿੱਦਾਂ ਹੁਣ ਕਿਤੇ ਆਉਣਾ ਜਾਣਾ ਹੈਗਾ ਏ ਜਿੱਦਾਂ ਕਹਿੰਦੇ ਨਹੀਂ ਹੈਗੇ ਵੀ ਤੁਰ ਕੇ ਜਾਣ ਨੂੰ ਕਿਤੇ ਜਾਣ ਨੂੰ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈਗਾ ਹੈ ਜੇ ਆਪਾਂ ਸਾਡੇ ਕੋਲ਼ ਕੋਈ ਸਾਧਨ ਹੋਵੇ ਮੋਟਰਸੈਕਲ ਗੱਡੀ ਜਾਂ ਹੋਰ ਵੀ ਕੋਈ ਚੀਜ਼ ਹੋਵੇ ਉਹ ਦੇ ਨਾਲ਼ ਆਪਾਂ ਜਿਹੜਾ ਕਿਆ ਹੈਗਾ ਜਿਹੜਾ ਘੰਟਿਆਂ ਦਾ ਸਫ਼ਰ ਹੈ ਓਹ ਮਿੰਟਾਂ 'ਚ ਤੈਅ ਕਰ ਸਕਦੇ ਹੈਗੇ ਹੈ ਜਿਹੜਾ ਮਬੈਲ ਹੈਗਾ ਏ ਕਹਿੰਦੇ ਨਹੀਂ ਹੈਗੇ ਮਬੈਲ ਇਕੱਲਾ ਮਬੈਲ ਏ ਨਹੀਂ ਰਹਿ ਗਿਆ ਵਾ ਹੈਗਾ ਏ ਇਹਦੇ ਨਾਲ਼ ਆਪਾਂ ਬੇ ਬੰਦਾ ਪਹਿਲਾਂ ਜਿੱਦਾਂ ਪਹਿਲਾਂ ਕਹਿੰਦੇ ਰਹੇ ਮਬੈਲ ਨੂੰ ਸਿਰਫ਼ ਆਪਾਂ ਫੋਨ ਕਰਨ ਦੇ ਅਤੇ ਸੁਣਨ ਦਾ ਕੰਮ ਆਉਂਦਾ ਹੈਗਾ ਏ ਹੁਣ ਮਬੈਲ ਜਿਹੜਾ ਹੈਗਾ ਏ ਸਮਾਰਟ ਫੋਨ ਅੱਜ ਕੱਲ੍ਹ ਆ ਗਏ ਵੇ ਹੈਗੇ ਹੈ ਇਹਦੇ ਨਾਲ਼ ਕਿਆ ਹੁੰਦਾ ਹੈਗਾ ਜਿੱਦਾਂ ਕੋਈ ਵੀ ਦੁਨੀਆਂ ਦੇ ਕੋਨੇ ਦੀ ਤੁਸੀਂ ਬਈ ਇੱਥੇ ਘਰੀਂ ਬੈਠੇ ਦਾ ਹੀ ਹੁਸ਼ਿਆਰਪੁਰ ਬੈਠੇ ਦੇਖ ਸਕਦੇ ਹੈਗੇ ਹੈ ਬਈ ਕਿਸੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਕਿਆ ਕੁਛ ਚੱਲ ਰਿਹਾ ਹੈਗਾ ਏ ਕਿਆ ਕੁਛ ਦੀ ਦੀਨ ਦੁਨੀਆਂ 'ਚ ਹੋ ਰਿਹਾ ਹੈਗਾ ਉਹ ਸਾਰਾ ਕੁਛ ਆਪਾਂ ਘਰੇ ਬੈਠੇ ਘਰੀਂ ਆਪਣੇ ਅੰਦਰ ਬੈਠੇ ਉਹ ਸਾਰਾ ਕੁਛ ਦੇਖ ਸਕਦੇ ਇਹ ਸਾਰਾ ਕੁਝ ਜਿਹੜਾ ਹੈਗਾ ਏ ਸਾਨੂੰ ਮੋਬੈਲ ਸਾਡੇ ਸਾਹਮਣੇ ਚੰਗੀ ਜਾਣਕਾਰੀ ਲੈ ਕੇ ਪ੍ਰੋਸਦਾ ਹੈਗਾ ਏ ਇਸ ਤੋਂ ਇਲਾਵਾ ਜਿਹੜਾ ਹੈਗਾ ਏ ਮੈਂ ਇਹਨੂੰ ਆਪਣੀਆਂ ਕਲਾਸਾਂ ਲਾਣ ਵਾਸਤੇ ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਕੰਮ ਵਾਸਤੇ ਵਰਤ ਸਕਦਾ ਹੈਗਾ ਏ ਅਤੇ ਕਿਸੇ ਨਾਲ਼ ਗੱਲ ਕਰਨ ਵਾਸਤੇ ਉਸ ਤਰ੍ਹਾਂ ਲੈਪਟੋਪ ਦਾ ਵੀ ਮੈਂ ਜਿਹੜਾ ਹੈਗਾ ਏ ਜਿੱਦਾਂ ਕੋਈ ਕੰਮ ਕਰਨਾ ਹੋਵੇ ਕੁਛ ਸਿੱਖਣਾ ਹੋਵੇ ਵਰਡ ਪੈਡ ਵਗੈਰਾ ਜਾਂ ਹੋਰ ਕੁਛ ਜਿਹੜਾ ਜੇ ਆਪਣੇ ਕੰਪਿਊਟਰ ਰਿਲੇਟਡ ਕੁਛ ਸਿੱਖਣਾ ਹੋਵੇ ਉਹਦੇ ਵਾਸਤੇ ਜਿਹੜਾ ਹੈਗਾ ਹੈ ਮੈਂ ਆਪਣੀ ਟਕਨੋਲਜੀ ਦੀ ਵਰਤਦਾ ਹੈਗਾ ਇਹਦਾ ਇਹਦਾ ਮੇਰੀ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਸਾਰਥਕ ਪੋਜਟਿਵ ਪ੍ਰਭਾਵ ਹੈਗਾ ਏ